ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਹਜੇ ਬਹੁਤ ਸਾਰੀ ਇੰਪਰੂਵਮੈਂਟ ਦੀ ਲੋੜ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਸਾਫ਼ ਸਫ਼ਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਪਬਲਿਕ ਟੋਇਲਟ ਹੁੰਦੇ ਨੇ ਹਸਪਤਾਲਾਂ ਦੇ ਵਿੱਚ ਉਨ੍ਹਾਂ ਦੇ ਵਿੱਚ ਸਾਫ਼ ਸਫ਼ਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਇਨਫੈਕਸ਼ਨ ਨਾ ਫੈਲ ਸਕੇ ਜਿਹੜੇ ਸਫ਼ਾਈ ਕਰਮਚਾਰੀ ਹੈ ਉਹਨਾਂ ਨੂੰ ਉਹਨਾਂ ਨੂੰ ਬਾਰ ਬਾਰ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਇਨਫੈਕਸ਼ਨ ਫਰੀ ਰੱਖਣ ਉਸ ਜਗ੍ਹਾ ਨੂੰ ਅਤੇ ਟੋਕਨ ਸਿਸਟਮ ਹੋਣਾ ਚਾਹੀਦਾ ਹੈ ਰਿਸੈਪਸ਼ਨ ਦੇ ਉੱਤੇ ਔਨਲਾਈਨ ਟੋਕਨ ਸਿਸਟਮ ਅਗਰ ਉਪਲੱਬਧ ਹੋਵੇ ਤਾਂ ਮਰੀਜ਼ਾਂ ਨੂੰ ਘਰ ਬੈਠੇ ਹੀ ਪਤਾ ਲੱਗ ਜਾਏ ਕਿ ਉਹਨਾਂ ਦੀ ਟਰਨ ਕਿੰਨੇ ਵਜੇ ਅਤੇ ਕਿਸ ਟਾਈਮ 'ਤੇ ਆਉਣੀ ਹੈ ਔਰ ਸਾਰੇ ਡੋਕਟਰਾਂ ਦੀ ਸੂਚੀ ਔਨਲਾਈਨ ਅਵੇਲੇਬਲ ਹੋਣੀ ਚਾਹੀਦੀ ਹੈ ਤਾਂ ਜੋ ਘਰ ਤੋਂ ਘਰ ਤੋਂ ਨਿਕਲਣ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਹੋਵੇ ਕਿ ਉਹਨਾਂ ਨੇ ਕਿਹੜੇ ਵਿੰਗ ਦੇ ਵਿੱਚ ਜਾਣਾ ਅਤੇ ਕਿਹੜੇ ਦਿਨ ਕਿਹੜੇ ਡੋਕਟਰ ਦੀ ਡਿਊਟੀ ਹੈ ਇਹ ਸਾਰੀਆਂ ਚੀਜ਼ਾਂ ਅਗਰ ਔਨਲਾਈਨ ਚੜ ਜਾਣ ਤਾਂ ਲੋਕਾਂ ਦਾ ਬਹੁਤ ਸਾਰਾ ਸਮਾਂ ਬਚੇਗਾ